ਮੇਰੇ ਕੋਲ ਤੇਰ੍ਹਾਂ ਪਰੋ ਮੈਕਸ ਫੋਨ ਹੈ ਜਿਹਦੇ ਵਿੱਚ ਮੈਂ ਆਪਣੀਆਂ ਫੋਟੋਸ ਖਿੱਚਦੀ ਹਾਂ ਅਤੇ ਉਹ ਬਹੁਤ ਹੀ ਕਲੈਰਟੀਦਾਰ ਫੋਨ ਹੈ ਅਤੇ ਮੈਨੂੰ ਉਹਦੇ ਵਿੱਚ ਫੋਟੋ ਖਿੱਚਣਾ ਬਹੁਤ ਹੀ ਪਸੰਦ ਹਨ ਅਤੇ ਮੈਂ ਫੋਟੋਆਂ ਦੀ ਬਹੁਤ ਜ਼ਿਆਦਾ ਸ਼ੌਕੀਨ ਹਾਂ ਅਤੇ ਮੈਂ ਕਿਤੇ ਵੀ ਜਾਂਦੀ ਹਾਂ ਘੁੰਮਣ ਫਿਰਨ ਐਜ ਆ ਮੈਮਰੀ ਰੱਖਣ ਲਈ ਮੈਂ ਹਰ ਇੱਕ ਜਗ੍ਹਾ ਦੀ ਫੋਟੋ ਖਿੱਚਦੀ ਹਾਂ ਅਤੇ ਮੈਂ ਖੁਦ ਦੀਆਂ ਵੀ ਖਿੱਚਾਉਂਦੀ ਹਾਂ ਤਾਂ ਕਿ ਲਾਈਫ ਟਾਈਮ ਲਈ ਉਹ ਮੇਰੇ ਕੋਲ ਰਹਿਣ ਚੀਜ਼ਾਂ ਅਤੇ ਮੈਂ ਉਨ੍ਹਾਂ ਨੂੰ ਦੇਖ ਦੇਖ ਕੇ ਖੁਸ਼ ਹੋਵਾਂ ਅਤੇ ਮੈਂ ਆਪਣੇ ਮੈਮਰੀਜ਼ ਕ੍ਰੀਏਟ ਕਰਾਂ ਅਤੇ ਜੇ ਮੈਂ ਚਾਰ ਹੋਰਾਂ ਨੂੰ ਵੀ ਦਿਖਾਵਾਂ ਕਿ ਮੈਂ ਕਿੱਥੇ ਕਿੱਥੇ ਘੁੰਮ ਫਿਰ ਕੇ ਆਈ ਹੋਈ ਹਾਂ ਅਤੇ ਫੋਟੋਗ੍ਰਾਫੀ ਇੱਕ ਇਹ ਜਿਹੀ ਚੀਜ਼ ਹੈ ਜਿਹੜੀ ਲਾਈਫ ਟਾਈਮ ਨੂੰ ਆਪਣੇ ਨਾਲ ਰਹਿ ਸਕਦੀ ਹੈ ਆਪਾਂ ਉਹਨੂੰ ਐਜ਼ ਆ ਮੈਮਰੀ ਆਪਣੇ ਫੋਨ ਵਿੱਚ ਰੱਖ ਸਕਦੇ ਹਾਂ ਅਤੇ ਕੈਮਰਾ ਸਾਡੀ ਵਰਤੋਂ ਦੀ ਔਲਵੇਜ ਅੱਜ ਇੱਕ ਹਰ ਇੱਕ ਬੰਦੇ ਲਈ ਅੱਜ ਕੱਲ੍ਹ ਜੋ ਕੈਮ ਆਈਫੋਨ ਆ ਕੋਈ ਵੀ ਐਂਡਰਾਇਡ ਫੋਨ ਆ ਕੈਮਰੇ ਵਾਲਾ ਫੋਨ ਆ ਉਹ ਹਰ ਇੱਕ ਬੰਦੇ ਲਈ ਬਹੁਤ ਹੀ ਜ਼ਿਆਦਾ ਜ਼ਰੂਰੀ ਆ ਕਿਉਂਕਿ ਹਰ ਇੱਕ ਨੂੰ ਸ਼ੌਕ ਹੁੰਦਾ ਹੈ ਆ ਫੋਟੋ ਖਿੱਚਣ ਦਾ